ਹਾਂਜੀ ਅੱਛਾ ਜੀ ਠੀਕ ਹੈ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਮ ਜੇ ਤਾਂ ਤੁਸੀਂ ਸਬਜ਼ੀਆਂ ਕੁਛ ਜ਼ਿਆਦਾ ਕੁਆਂਟੀਟੀ 'ਚ ਲੈਣੀਆਂ ਨੇ ਤਾਂ ਇੱਥੇ ਸਨੋਰ ਬਹੁਤ ਵੱਡੀ ਮੰਡੀ ਲੱਗਦੀ ਹੈ ਅਤੇ ਬੜੇ ਸਸਤੇ ਰੇਟ ਦੇ ਉੱਪਰ ਉੱਥੋਂ ਸਬਜ਼ੀਆਂ ਜਿਹੜੀਆਂ ਨੇ ਮਿਲ ਜਾਂਦੀਆਂ ਨੇ ਅਤੇ ਤਾਜ਼ਾ ਸਬਜ਼ੀਆਂ ਹੁੰਦੀਆਂ ਨੇ ਜੀ ਬਿਲਕੁਲ ਅਤੇ ਜੇ ਮਤਲਬ ਜਿਵੇਂ ਆਮ ਰੂਟੀਨ ਲਈ ਲੈਣੀਆਂ ਹੋਣ ਤਾਂ ਇੱਥੇ ਪੰਦਰ੍ਹਾਂ ਨੰਬਰ ਫਾਟਕ ਹੈ ਉੱਥੇ ਵੀ ਸਬਜ਼ੀਆਂ ਹੁੰਦੀਆਂ ਨੇ ਬਿਲਕੁਲ ਤਾਜ਼ਾ ਹੁੰਦੀਆਂ ਨੇ ਸਬਜ਼ੀਆਂ ਉੱਥੋਂ ਵੀ ਤੁਸੀਂ ਲੈ ਸਕਦੇ ਹੋ ਅਤੇ ਇਸਨੂੰ ਹਾਂਜੀ ਇਸ ਤੋਂ ਇਲਾਵਾ ਹਾਂਜੀ ਬੋਲੋ ਹਾਂਜੀ ਹਾਂਜੀ ਠੀਕ ਹੈ ਮੈਮ ਵੈਸੇ ਜੇ ਤੁਸੀਂ ਸ਼ਨੀਵਾਰ ਜਾਣਾ ਏ ਤਾਂ ਅਰਬਨ ਸਟੇਟ ਨਾ ਉੱਥੇ ਵੀ ਕਾਫੀ ਵੱਡੀ ਮੰਡੀ ਲੱਗਦੀ ਹੈ ਹਰ ਸ਼ਨੀਵਾਰ ਤਾਂ ਉੱਥੇ ਵੀ ਤਾਜ਼ੀਆਂ ਸਬਜ਼ੀਆਂ ਮਿਲਦੀਆਂ ਨੇ ਅਤੇ ਇਸ ਤੋਂ ਇਲਾਵਾ ਬੁੱਧਵਾਰ ਵੀ ਇੱਧਰ ਸ਼ਹਿਰ ਦੇ ਵਿੱਚ ਮੰਡੀ ਲੱਗਦੀ ਮਤਲਬ ਵੱਖਰੇ ਵੱਖਰੇ ਦਿਨਾਂ ਦੇ ਵਿੱਚ ਪਟਿਆਲੇ ਕਿਤੇ ਨਾ ਕਿਤੇ ਮੰਡੀ ਜਿਹੜੀ ਆ ਸਬਜ਼ੀਆਂ ਦੀ ਲੱਗਦੀ ਰਹਿੰਦੀ ਹੈ ਅਤੇ ਤਾਜ਼ੀਆਂ ਸਬਜ਼ੀਆਂ ਹੁੰਦੀਆਂ ਨੇ ਅਤੇ ਬਾਕੀ ਸਾਡੇ ਨਾਲ ਜਾਣ ਦੇ ਵਿੱਚ ਇੰਟਰਸਟਡ ਹੋ ਤਾਂ ਕੋਈ ਸਮੱਸਿਆ ਨਹੀਂ ਹੈਗੀ ਅਤੇ ਆਪਾਂ ਇਕੱਠੇ ਜਾ ਕੇ ਵੀ ਸਨੌਰ ਵੱਡੀ ਮੰਡੀ ਤੋਂ ਤਾਜ਼ੀਆਂ ਅਤੇ ਜ਼ਿਆਦੀਆਂ ਸਬਜ਼ੀਆਂ ਲਿਆ ਸਕਦੇ ਹਾਂ ਜੀ ਹਾਂਜੀ ਅਤੇ ਤੁਸੀਂ ਮਤਲਬ ਪਹਿਲਾਂ ਦੱਸ ਦਿਓ ਵੀ ਜਿਸ ਦਿਨ ਤੁਸੀਂ ਇੰਟਰਸਟਿਡ ਹੋਵੋਗੇ ਹਾਂਜੀ ਠੀਕ ਹੈ ਮੈਮ ਠੀਕ ਹੈ ਜੀ ਬਿਲਕੁਲ ਇਕੱਠੇ ਚੱਲਾਂਗੇ ਜੀ ਓਕੇ ਜੀ